ਖੇਤੀਬਾੜੀ ਲਈ ਮੁੱਖ ਤੌਰ 'ਤੇ ਚਾਰ ਸਾਧਨ ਜ਼ਿਆਦਾ ਵਰਤੋਂ ਵਿੱਚ ਆਉਂਦੇ ਨੇ ਜਿਵੇਂ ਟਰੈਕਟਰ ਟਰਾਲੀ ਕੰਬਾਇਨ ਸੁਹਾਗਾ ਟਰੈਕਟਰ ਦਾ ਕੰਮ ਹੈ ਟਰੈਕਟਰ ਬੀਜ ਲਿਆਉਣ ਲਈ ਬੀਜ ਵਰਤਣ ਲਈ ਮੰਡੀ ਤੋਂ ਸਮਾਨ ਲਿਆਉਣ ਲਈ ਜਾਂ ਪਿੱਛੇ ਸੁਹਾਗਾ ਲਾ ਕੇ ਹੱਲ ਲਾ ਕੇ ਵਾਹਣ ਲਈ ਕਰਨ ਖਿੱਚਣ ਲਈ ਪੱਧਰਾ ਕਰਨ ਲਈ ਵਰਤਿਆ ਜਾਂਦਾ ਟਰੈਕਟਰ ਟਰਾਲੀ ਵਰਤੇ ਜਾਂਦੇ ਨੇ ਨੇ ਤੂੜੀ ਭਰ ਕੇ ਉਹਨੂੰ ਛੱਡ ਕੇ ਆਉਣਾ ਕਣਕ ਕੱਢੀ ਕਣਕ ਨੂੰ ਮੰਡੀ 'ਚ ਛੱਡ ਕੇ ਆਉਣਾ ਅਤੇ ਜੀਰੀ ਨੂੰ ਮੰਡੀ 'ਚ ਛੱਡੇ ਕੇ ਆਉਣਾ ਕੋਈ ਵੀ ਚੀਜ਼ ਜਿਹੜੀ ਫ਼ਸਲ ਹੈ ਉਹਨੂੰ ਮੰਡੀ 'ਚ ਛੱਡ ਕੇ ਆਉਣਾ ਅਤੇ ਟਿਊਬਵੈੱਲ ਵਗੈਰਾ ਵਰਤੇ ਜਾਂਦੇ ਹਨ ਬੋਰ ਕਰਾ ਕੇ ਉਹ ਪਾਣੀ ਲਈ ਖੇਤੀ ਨੂੰ ਸਭ ਤੋਂ ਵੱਧ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਾਣੀ ਲਈ ਵਰਤੇ ਜਾਂਦੇ ਨੇ ਇਸ ਤੋਂ ਇਲਾਵਾ ਖੇਤੀ ਵਿੱਚ ਹੋਰ ਕਈ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਜਿਵੇਂ ਅੱਜ ਕੱਲ੍ਹ ਨਵੀਆਂ ਮਸ਼ੀਨਾਂ ਆਈਆਂ ਨੇ ਉਹ ਜਿਹੜੀ ਖੇਤੀ ਦੇ ਕਟਾਈ ਤੋਂ ਬਾਅਦ ਜੜ੍ਹਾਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਖਿੱਚ ਕੇ ਖੇਤ ਨੂੰ ਸਾਫ਼ ਕਰ ਦਿੰਦੀਆਂ ਨੇ ਅਤੇ ਇਸ ਤੋਂ ਇਲਾਵਾ ਹੋਰ ਕੰਬਾਈਨ ਜਿਹੜੀ ਹੈ ਮੇਨ ਤੌਰ 'ਤੇ ਪਹਿਲਾਂ ਹੱਥਾਂ ਨਾਲ ਦਾਤੀਆਂ ਨਾਲ ਕਟਾਈ ਹੁੰਦੀ ਸੀ ਹੁਣ ਕੰਬਾਈਨ ਨਾਲ ਕਟਾਈ ਹੁੰਦੀ ਹੈ ਕੰਬਾਈਨ ਕਟਾਈ ਲਈ ਵਰਤੀ ਜਾਂਦੀ ਹੈ